ਇਸ ਖੇਤਰ ਵਿੱਚ ਮੇਰੇ ਦੁਆਰਾ ਦੇਖੇ ਗਏ ਪੰਛੀ ਹਨ ਮੋਰ ਤੋਤਾ ਚਿੜੀ ਕਾਂ ਕਬੂਤਰ ਬਾਜ ਗਟਾਰ ਗਰੜ ਪੱਖ ਉੱਲੂ ਇਹਨਾਂ ਸਾਰੇ ਪੰਛੀਆਂ ਵਿੱਚੋਂ ਜੇ ਕਿਸੇ ਇੱਕ ਪੰਛੀ ਦਾ ਨਾਮ ਲੈਣਾ ਹੋਵੇ ਤਾਂ ਉਹ ਮੇਰੇ ਲਈ ਮੁਸ਼ਕਿਲ ਹੈ ਕਿਉਂਕਿ ਪੰਛੀ ਵੈਸੇ ਆਪਣੇ ਆਪ ਵਿੱਚ ਸਾਰੇ ਹੀ ਬੜੇ ਖੂਬਸੂਰਤ ਹਨ ਸੁੰਦਰ ਹਨ ਮਨ ਨੂੰ ਮੋਹਣ ਵਾਲੇ ਹਨ ਪਰ ਫਿਰ ਵੀ ਜੇ ਕੁਝ ਵਧੇਰੇ ਪਸੰਦ ਪੰਛੀਆਂ ਦੀ ਗੱਲ ਕਰਾਂ ਤਾਂ ਇੱਕ ਤੋਂ ਵਧੇਰੇ ਪੰਛੀਆਂ ਦਾ ਨਾਮ ਲੈਣਾ ਮੈਂ ਪਸੰਦ ਕਰਾਂਗੀ ਸਭ ਤੋਂ ਪਹਿਲਾਂ ਕਾਂ ਕਾਂ ਅਸਲ ਵਿੱਚ ਸਾਡੇ ਪੰਜਾਬੀ ਸੱਭਿਆਚਾਰ ਦੇ ਵਿੱਚ ਜੁੜਿਆ ਹੋਇਆ ਇੱਕ ਸ਼ਬਦ ਹੈ ਇਹ ਮੰਨਿਆ ਜਾਂਦਾ ਗਾ ਕਿ ਜਦੋਂ ਵੀ ਸਾਡੇ ਘਰ ਦੇ ਵਿੱਚ ਕਿਸੇ ਮਹਿਮਾਨ ਰਿਸ਼ਤੇਦਾਰ ਪ੍ਰੋਹੁਣੇ ਨੇ ਆਉਣਾ ਹੋਵੇ ਤਾਂ ਕਾਂ ਬਨੇਰੇ 'ਤੇ ਬੈਠ ਕੇ ਬੋਲਦਾ ਹੈ ਤਾਂ ਉਹ ਇੱਕ ਕਿਸੇ ਮਹਿਮਾਨ ਦੇ ਅਤਿਥੀ ਦੇ ਆਉਣ ਦਾ ਸੰਕੇਤ ਦਿੰਦਾ ਹੈ ਇਸ ਤੋਂ ਇਲਾਵਾ ਮੈਨੂੰ ਚਿੜੀਆਂ ਪਸੰਦ ਹਨ ਖ਼ਾਸ ਕਰਕੇ ਜਦੋਂ ਸਵੇਰ ਦਾ ਵਕਤ ਹੁੰਦਾ ਹੈ ਤਾਂ ਚਿੜੀਆਂ ਚਹਿਕਦੀਆਂ ਹਨ ਉਹਨਾਂ ਦਾ ਚਹਿਕਣਾ ਸਾਨੂੰ ਇੱਕ ਸੰਦੇਸ਼ ਦਿੰਦਾ ਹੈ ਉੱਠਣ ਲਈ ਕਿ ਸਵੇਰਾ ਹੋ ਗਿਆ ਤਾਂ ਉਹਨਾਂ ਦੀ ਉਹ ਮਨਮੋਹਕ ਆਵਾਜ਼ ਮੈਨੂੰ ਬੜੀ ਚੰਗੀ ਲੱਗਦੀ ਹੈ ਇਸ ਤੋਂ ਇਲਾਵਾ ਮੋਰ ਪੰਛੀ ਮੈਨੂੰ ਬੜਾ ਸੁੰਦਰ ਲੱਗਦਾ ਹੈ ਅਸਲ ਵਿੱਚ ਸ਼ਾਇਦ ਹੀ ਕੋਈ ਐਸਾ ਵਿਅਕਤੀ ਹੋਵੇਗਾ ਜਿਸ ਨੂੰ ਮੋਰ ਪੰਛੀ ਪਸੰਦ ਨਾ ਹੋਵੇ ਮੋਰ ਬੜਾ ਹੀ ਸੁੰਦਰ ਹੈ ਪੰਛੀ ਹੁੰਦਾ ਹੈ ਉਸਦੇ ਪੰਖ ਖੰਭ ਬੜੇ ਸੁੰਦਰ ਹੁੰਦੇ ਹਨ ਆਪਣੇ ਖੰਭਾਂ ਕਰਕੇ ਰੰਗ ਬਿਰੰਗੇ ਖੰਭਾਂ ਕਰਕੇ ਉਹ ਹਰ ਕਿਸੇ ਦਾ ਮਨਮੋਹਣ ਦੀ ਸ਼ਕਤੀ ਰੱਖਦਾ ਹੈ ਇਸ ਤੋਂ ਇਲਾਵਾ ਤੋਤਾ ਜਿਸ ਦੀ ਲਾਲ ਰੰਗ ਦੀ ਚੁੰਝ ਹੁੰਦੀ ਹੈ ਤਾਂ ਉਹ ਵੀ ਮੈਨੂੰ ਬੜਾ ਪਸੰਦ ਹੈ ਉਸ ਦਾ ਜਿਹੜਾ ਚੁੰਝ 'ਤੇ ਉਸਦੇ ਜਿਹੜਾ ਹਰੇ ਰੰਗ ਦਾ ਆਪਸ ਦੇ ਵਿੱਚ ਇੱਕ ਕੋਬੀਨੇਸ਼ਨ ਹੈ ਉਹ ਬੜਾ ਖੂਬਸੂਰਤ ਹੈ ਤਾਂ ਇਸ ਕਰਕੇ ਮੈਨੂੰ ਇਹ ਪੰਛੀ ਜਿਹੜੇ ਆ ਪਸੰਦ ਹਨ